ਪੰਜਾਬੀ ਭਾਸ਼ਾ ਬਹੁਤ ਹੀ ਪ੍ਰਸਿੱਧ ਭਾਸ਼ਾ ਹੈ ਅਤੇ ਇਹ ਭਾਸ਼ਾ ਪੰਜਾਬ ਵਿੱਚ ਬਾ ਬਹੁਤ ਜ਼ਿਆਦਾ ਲੋਕ ਬੋਲਦੇ ਹਨ ਅਤੇ ਮੈਂ ਵੀ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਨਾਲ ਸਮਾਨ ਖਰੀਦਣ ਜਾਂਦਾ ਹਾਂ ਤਾਂ ਪੰਜਾਬੀ ਭਾਸ਼ਾ ਵਿੱਚ ਗੱਲ ਕਰਦਾ ਹਾਂ ਜਿਵੇਂ ਕਿ ਮੇਰੇ ਨੇੜੇ ਕਈ ਬਜ਼ਾਰ ਹਨ ਉੱਥੇ ਬੋਰਡ ਅਤੇ ਸਾਈਨ ਵਾਲੇ ਬੋਰਡ ਵੀ ਪੰਜਾਬੀ ਵਿੱਚ ਹਨ ਜਦੋਂ ਵੀ ਕਦੇ ਮੈਂ ਮੰਡੀ ਵਿੱਚ ਮੇਰੇ ਮਾਂ ਪਿਓ ਨਾਲ ਆਪਣੀ ਫਸਲ ਵੇਚਣ ਜਾਂਦਾ ਹਾਂ ਤਾਂ ਮੈਂ ਆਪਣੇ ਆੜਤੀਏ ਨਾਲ ਪੰਜਾਬੀ ਵਿੱਚ ਗੱਲ ਕਰਦਾ ਹਾਂ ਪੰਜਾਬੀ ਭਾਸ਼ਾ ਬਹੁਤ ਹੀ ਜ਼ਿਆਦਾ ਸਰਲ ਭਾਸ਼ਾ ਹੈ ਅਤੇ ਮੈਂ ਜਦੋਂ ਵੀ ਪੰਜਾਬੀ ਬੋਹਲ ਬੋਲਦਾ ਹਾਂ ਮੈਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਵੀ ਮੈਂ ਕਿਸੇ ਵੀ ਤਰ੍ਹਾਂ ਦਾ ਸਮਾਨ ਘਰ ਦਾ ਸਮਾਨ ਜਾਂ ਰਾਸ਼ਨ ਖਰੀਦਦਾ ਹਾਂ ਉਸ ਸਮੇਂ ਮੈਂ ਪੰਜਾਬੀ ਵਿੱਚ ਗੱਲ ਕਰਦਾ ਹਾਂ ਪੰਜਾਬੀ ਭਾਸ਼ਾ ਦੇ ਬਹੁਤ ਸਾਰੇ ਫਾਇਦੇ ਵੀ ਹਨ ਅਤੇ ਇਹ ਭਾਸ਼ਾ ਭਾਸ਼ਾ ਇਹ ਭਾਸ਼ਾ ਬਹੁਤ ਹੀ ਪ੍ਰਸਿੱਧ ਭਾਸ਼ਾ ਹੈ ਅਤੇ ਮੈਂ ਪੰਜਾਬੀ ਜਦੋਂ ਵੀ ਮੈਂ ਕਿਤੇ ਬਾਹਰਲੀ ਸਟੇਟ ਵਿੱਚ ਜਾਂਦਾ ਹਾਂ ਉਦੋਂ ਵੀ ਮੈਂ ਪੰਜਾਬੀ ਭਾਸ਼ਾ ਵਰਤਦਾ ਹਾਂ ਅਤੇ ਨਾਲ ਹੀ ਨਾਲ ਜਦੋਂ ਵੀ ਮੈਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਨਵੀਂ ਚੀਜ਼ ਖਰੀਦਦਾ ਹਾਂ ਜਾਂ ਮੈਂ ਆਪਣੇ ਸਕੂਲ ਜਾਂਦਾ ਹਾਂ ਉੱਥੇ ਵੀ ਮੈਂ ਆਪਣੇ ਫੀਸ ਦਾ ਫਾਰਮ ਪੰਜਾਬੀ ਵਿੱਚ ਭਰਦਾ ਹਾਂ ਅਤੇ ਨਾਲ ਹੀ ਨਾਲ ਬੈਂਕ ਵਿੱਚ ਵੀ ਪੰਜਾਬੀ ਭਾਸ਼ਾ ਵਿੱਚ ਫਾਰਮ ਭਰਨ ਦਾ ਖਾਸ ਪ੍ਰਬੰਧ ਹੈ ਅਤੇ ਮੇਰੇ ਮਾਤਾ ਜੀ ਜਦੋਂ ਵੀ ਬੈਂਕ ਵਿੱਚ ਜਾਂਦੇ ਹਨ ਤਾਂ ਅਪਣਾ ਵੋਚਰ ਪੰਜਾਬੀ ਭਾਸ਼ਾ ਵਿੱਚ ਭਰਦੇ ਹਨ ਕਿਉਂਕਿ ਇਹ ਸਾਡੀ ਮਾਂ ਬੋਲੀ ਭਾਸ਼ਾ ਹੈ ਅਤੇ ਮੇਰੇ ਮੁਤਾਬਿਕ ਸਾਰੇ ਲੋਕਾਂ ਨੂੰ ਪੰਜਾਬੀ ਵਿੱਚ ਵਪਾਰ ਅਤੇ ਵਣਜ ਲਈ ਵਰਤਣਾ ਚਾਹੀਦਾ ਹੈ